ਹਾਂਜੀ ਨਮਸਤੇ ਜੀ ਹਾਂ ਖੇਤੀਬਾੜੀ ਬਾਰੇ ਮੈਂ ਦੱਸਣਾ ਸੀ ਕਿ ਪੰਜਾਬ ਦੀ ਖੇਤੀ ਕਾਫੀ ਉਪਜਾਊ ਹੈ ਅਤੇ ਇਹਦੇ ਕਾਰਨ ਵੀ ਹਾਂ ਤੁਹਾਡੇ ਕੀ ਵਿਚਾਰ ਹੈ ਕਿ ਕਿੱਦਾਂ ਦੀ ਹੈ ਜਾਂ ਹਾਂਜੀ ਹਾਂਜੀ ਹਾਂ ਹਾਂ ਇੱਥੇ ਬੰਬੀਆਂ ਵਗੈਰਾ ਵੀ ਲੱਗਦੀਆਂ ਅਤੇ ਸਾਰਾ ਪਾਣੀ ਪੂਣੀ ਚੰਗਾ ਮਿਲ ਜਾਂਦਾ ਅਤੇ ਫਿਰ ਤਾਂ ਕਰਕੇ ਫਸਲ ਵੀ ਚੰਗੀ ਹੁੰਦੀ ਹੈ ਹਾਂ ਅਤੇ ਉਹਦੇ ਕਾਰਨ ਹੀ ਕਾਫੀ ਸਰਕਾਰ ਨੂੰ ਵੀ ਕਾਫੀ ਫਾਇਦਾ ਇਹਦੇ ਕਾਰਨ ਕਿ ਕਾਫੀ ਆਰਥਿਕ ਸਥਿਤੀ 'ਤੇ ਵੀ ਸੁਧਾਰ ਆਇਆ ਹਾਂਜੀ ਹਾਂਜੀ ਹਾਂ ਹਾਂਜੀ

ਹਾਂਜੀ ਚੰਗਾ ਜੀ ਫਿਰ ਨਮਸਕਾਰ